ਜੇਕਰ ਦੇਖੀਏ ਤਾਂ ਡਾਂਸ ਇੱਕ ਇਹੋ ਜਿਹਾ ਹੈ ਰੀਤੀ ਰਿਵਾਜਾਂ ਰਸਮ ਹੈ ਜਿਸਦੇ ਇੱਕ ਵਿਅਕਤੀ ਦੇ ਕਰਨ ਨਾਲ ਹੀ ਦੂਜੇ ਦੇਖਣ ਵਾਲੇ ਵਿਅਕਤੀ ਦੇ ਦਿਲ ਵਿੱਚ ਵੀ ਉਤਾਵਨਾ ਪੈਦਾ ਹੁੰਦੀ ਹੈ ਕਿ ਮੈਂ ਵੀ ਭੰਗੜਾ ਪਾਵਾਂ ਡਾਂਸ ਕਰਾਂ ਇਹ ਇੱਕ ਇਹੋ ਜਿਹਾ ਤਰੀਕਾ ਹੈ ਜਦੋਂ ਕੋਈ ਡਾਂਸ ਕਰਦੇ ਤਾਂ ਸਾਰੇ ਇਕੱਠੇ ਹੁੰਦੇ ਹਨ ਸ਼ੌਕ ਪੈਦਾ ਹੁੰਦਾ ਅਸੀਂ ਇਕੱਠੇ ਹੋ ਕੇ ਡਾਂਸ ਕਰੀਏ ਭੰਗੜਾ ਪਾਈਏ ਭਾਈਚਾਰੇ ਦੇ ਲੋਕ ਇਕੱਠੇ ਹੁੰਦੇ ਹਨ ਅਤੇ ਭੰਗੜਾ ਪਾਉਂਦੇ ਡਾਂਸ ਇਹੋ ਜਿਹਾ ਤਰੀਕਾ ਹੈ ਜਿਸ ਦੇ ਨਾਲ਼ ਸਾਰਿਆਂ ਦੇ ਦਿਲ ਵਿੱਚ ਭਾਵਨਾ ਅਤੇ ਇਕੱਠਤਾ ਪੈਦਾ ਹੁੰਦੀ ਹੈ ਅਤੇ ਸਾਰੇ ਇਕੱਠੇ ਹੋ ਕੇ ਮਨੋਰੰਜਨ ਕਰਦੇ ਹਨ